ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਦੀਪਕ ਵਾਸੂ ਐ ਮੈਂ ਗੁਰਦਾਸਪੁਰ ਤੋਂ ਆ ਮੈਂ ਇੱਕ ਰਾਧੇ ਰਾਧੇ ਰੈਸਟੋਰੈਂਟ 'ਤੇ ਇੱਕ ਆਰਡਰ ਦਿੱਤਾ ਸੀ ਦਾਲ ਮੱਖਣੀ ਮਿਕਸ ਵੈੱਜ ਮਟਰ ਪਨੀਰ ਸ਼ਾਹੀ ਪਨੀਰ ਤੇ ਅਠਾਰਾਂ ਰੋਟੀਆਂ ਸੀ ਕੇਕ ਸੀ ਤੇ ਗੁਲਾਬ ਜਾਮੁਨ ਸੀ ਲੇਕਿਨ ਉਹ ਆਰਡਰ ਮੇਰੇ ਕੋਲ ਇੱਕ ਤਾਂ ਲੇਟ ਆਇਆ ਕਾਫੀ ਲੇਟ ਆਇਆ ਤੇ ਦੂਸਰਾ ਜਿਹੜੀ ਚੀਜ਼ਾਂ ਮੈਂ ਆਡਰ 'ਤੇ ਕੀਤੀਆਂ ਸੀ ਜਿਹੜੀਆਂ ਵੀ ਹੈਗੀਆਂ ਉਸ ਕੁਛ ਵੀ ਨੀ ਉਹਨਾਂ ਚੋਂ ਆਇਆ ਸਭ ਕੁਛ ਉਲਟ ਆਇਆ ਮੈਂ ਦਾਲ ਮੱਖਣੀ ਕੀਤੀ ਸੀ ਇਹਨਾਂ ਨੇ ਮੈਨੂੰ ਪਤਾ ਨਹੀਂ ਕੀ ਭੇਜ ਤਾ ਹੋਰ ਹੀ ਕੁਝ ਭੇਜ ਦਿੰਦੇ ਆ ਤੇ ਮੈਂ ਬੇਨਤੀ ਕਰਦਾ ਕੀ ਜਿਹੜਾ ਮੇਰਾ ਆਰਡਰ ਆ ਇਹਨੂੰ ਰੱਦ ਕੀਤਾ ਜਾਵੇ ਧੰਨਵਾਦ ਜੀ